ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਮੌਸਮ ਦੇ ਅਨੁਕੂਲ ਹੀ ਹਰੇ ਇੱਕ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਮੌਸਮ ਦੇ ਅਨੁਕੂਲ ਹੀ ਹਰੇਕ ਫਸਲ ਵੱਢੀ ਜਾਂਦੀ ਹੈ ਜੇਕਰ ਕਿਤੇ ਮੌਸਮ ਦੀ ਖ਼ਰਾਬੀ ਜਿਵੇਂ ਕਿ ਗੜੇਮਾਰੀ ਹੋ ਜਾਵੇ ਜਾਂ ਕੋਈ ਫ਼ਸਲ ਖ਼ਰਾਬ ਹੋ ਜਾਵੇ ਉਸ ਤੇ ਜਗ੍ਹਾ ਸਾਨੂੰ ਸਮੇਂ ਦੇ ਅਨੁਕੂਲ ਵੇਖ ਕੇ ਜਾਂ ਤਾਂ ਕੋਈ ਚਾਰਾ ਜਿਵੇਂ ਬਰਸੀਮ ਜਾਂ ਗਰਮੀ ਵਿੱਚ ਕਿਸੇ ਕਿਸਮ ਦੀ ਚਰੀ ਬਾਜਰਾ ਜਵਾਰ ਆਦਿ ਉਸ ਜਗ੍ਹਾ 'ਤੇ ਕਾਸ਼ਤ ਕੀਤੀ ਜਾ ਸਕਦੀ ਹੈ ਬਾਕੀ ਹਰ ਸਮੇਂ ਮੌਸਮ ਦਾ ਧਿਆਨ ਰੱਖਿਆ ਜਾਂਦਾ ਹੈ ਔਰ ਦੇਖ ਕੇ ਮੌਸਮ ਸਮਾਂ ਟਾਈਮ ਪਾਣੀ ਲਗਾਇਆ ਜਾਂਦਾ ਹੈ ਅੱਜ ਕੱਲ੍ਹ ਨੈਟ ਉੱਪਰ ਹਰ ਇੱਕ ਬਾਰਿਸ਼ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਇਸ ਲਈ ਅਸੀਂ ਹਰ ਇੱਕ ਮੌਸਮ ਦਾ ਧਿਆਨ ਰੱਖਦੇ ਹਾਂ ਔਰ ਮੌਸਮ ਸਮਾਂ ਵੇਖ ਕੇ ਹੀ ਪਾਣੀ ਲਗਾਇਆ ਜਾਂਦਾ ਹੈ